ਅੱਜ ਕੱਲ੍ਹ ਆਪਾਂ ਵੇਖ ਹੀ ਸਕਦੇ ਹੈਗੇ ਆ ਕਿ ਜਿਵੇਂ ਅੱਜ ਕੱਲ੍ਹ ਲੋਕ ਹੈਗੇ ਆ ਗੇ ਉਹ ਅੱਜ ਕੱਲ੍ਹ ਜਿਹੜੀਆਂ ਬੈਂਕਿੰਗ ਐਪਸ ਆਈਆਂ ਗੀਆਂ ਜਿਵੇਂ ਗੂਗਲ ਪੇਅ ਵਗੈਰਾ ਹੋ ਗਿਆ ਪੇਟੀਐਮ ਵਗੈਰਾ ਹੋ ਗਿਆ ਫੋਨਪੇ ਵਗੈਰਾ ਹੋ ਗਿਆ ਇਹਨਾਂ ਦਾ ਯੂਜ ਹੈਗਾ ਗਾ ਜਿਹੜਾ ਬਹੁਤ ਹੀ ਜ਼ਿਆਦਾ ਕਰਨ ਲੱਗ ਪਏ ਹੈਗੇ ਜਿਵੇਂ ਆਪਾਂ ਵੇਖਦੇ ਹੈਗੇ ਪਹਿਲਾਂ ਦੇ ਟਾਈਮ ਦੇ ਵਿੱਚ ਜਦੋਂ ਇਹ ਬੈਂਕਿੰਗ ਐਪਸ ਨਹੀਂ ਬਣੀਆਂ ਸੀ ਪਹਿਲਾਂ ਲੋਕ ਕੀ ਸੀਗੇ ਹੈਗੇ ਉਹਨਾਂ ਦੇ ਕੋਲ ਕੋਈ ਟਰਾਂਸਪੋਰਟੇਸ਼ਨ ਦਾ ਸਾਧਨ ਵੀ ਨਹੀਂ ਸੀਗਾ ਠੀਕ ਹੈ ਵੀ ਉਹ ਕਿਸੇ ਵਹੀਕਲ ਵਗੈਰਾ 'ਤੇ ਜਾ ਕੇ ਵੀ ਉਹ ਆਪਣੇ ਜਿਹੜਾ ਹੈਗਾ ਗਾ ਵੀ ਇਹ ਬੈਂਕ ਦੇ ਵਿੱਚ ਜਾ ਕੇ ਆਪਣਾ ਕੰਮ ਕਰ ਸਕਣ ਉਹਨਾਂ ਦੇ ਕੋਲ ਸਿਰਫ਼ ਇੱਕ ਸਾਈਕਲ ਹੀ ਹੁੰਦਾ ਸੀ ਪਹਿਲਾਂ ਵਾਲੇ ਲੋਕਾਂ ਦੇ ਕੋਲ ਅਤੇ ਉਹ ਕੀ ਆ ਉਹਨਾਂ ਸਾਈਕਲ 'ਤੇ ਇੱਕ ਸ਼ਹਿਰ ਇੱਕ ਪਿੰਡ ਤੋਂ ਜਾਂ ਸ਼ਹਿਰ ਤੋਂ ਦੂਜੇ ਪਿੰਡ ਜਾਂ ਸ਼ਹਿਰ 'ਚ ਜਾਂਦੇ ਹੁੰਦੇ ਸੀ ਬੈਂਕਾਂ ਦੇ ਵਿੱਚ ਠੀਕ ਹੈ ਐਂਡ ਉੱਥੇ ਕੀ ਆ ਉਹਨਾਂ ਨੂੰ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਸੀਗਾ ਠੀਕ ਹੈ ਉਦੋਂ ਜਿਹੜੇ ਲੈਜਰ ਵਗੈਰਾ ਹੁੰਦੇ ਸੀ ਜਿਵੇਂ ਅੱਜ ਕੱਲ੍ਹ ਲੈਜਰ ਹੈਗਾ ਕੰਪਿਊਟਰ ਵਗੈਰਾ 'ਤੇ ਚਾੜੇ ਜਾਂਦੇ ਆ ਉਦੋਂ ਜਿਹੜੇ ਲੈਜਰ ਹੁੰਦੇ ਸੀ ਉਹ ਇੱਕ ਕਪ ਕਿਤਾਬ ਦੇ ਕਿਤਾਬ ਤਰ੍ਹਾਂ ਹੁੰਦਾ ਹੈਗਾ ਕੋਈ ਰਜਿਸਟਰ ਉਹਦੇ ਵਿੱਚ ਚੜ੍ਹਦੇ ਹੁੰਦੇ ਸੀ ਅਤੇ ਉੱਥੇ ਲੱਭਣਾ ਵਗੈਰਾ ਬਹੁਤ ਹੀ ਔਖਾ ਹੋ ਜਾਂਦਾ ਸੀਗਾ ਠੀਕ ਹੈ ਬਟ ਹੁਣ ਈਬੈਂਕਿੰਗ ਆ ਗਈ ਹੈਗੀ ਈਬੈਂਕਿੰਗ ਦੇ ਨਾਲ ਕੀ ਹੈਗਾ ਗਾ ਲੋਕ ਘਰ ਬੈਠੇ ਹੀ ਪੇਮੈਂਟਸ ਵਗੈਰਾ ਕਰ ਦਿੰਦੇ ਹੈਗੇ ਆ ਉਹਨਾਂ ਨੂੰ ਬੈਂਕ ਵਗੈਰਾ ਦੇ ਵਿੱਚ ਜਾਣ ਦੀ ਲੋੜ ਵੀ ਨਹੀਂ ਹੁੰਦੀ ਗੀ ਠੀਕ ਹੈ ਇੰਡੀਆ ਦੇ ਵਿੱਚ ਕੀ ਹੈਗਾ ਗਾ ਬੈਂਕਿੰਗ ਸੈਕਟਰ ਦੀ ਜਿਹੜੀ ਮਤਲਬ ਈਬੈਂਕਿੰਗ ਟੈਕਨੋਲੋਜੀ ਆਈ ਹੈਗੀ ਆ ਗੀ ਉਹਨੇ ਬੈਂਕਿੰਗ ਸੈਕਟਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਵੀ ਹੁਣ ਜਿਵੇਂ ਟੈਕਨੋਲੋਜੀ ਆਈ ਹੈਗੀ ਈ ਬੈਂਕਿੰਗ ਦੀ ਠੀਕ ਹੈ ਲੋਕ ਹੈਗੇ ਆ ਗੇ ਘਰ ਬੈਠੇ ਆਨਲਾਈਨ ਪੇਮੈਂਟਸ ਵਗੈਰਾ ਕਰੀ ਜਾਂਦੇ ਆ ਲੋ ਲੋਕ ਸਿਰਫ਼ ਬੈਂਕ ਦੇ ਵਿੱਚ ਉਦੋਂ ਹੀ ਜਾਂਦੇ ਹੈ ਜਦੋਂ ਉਹਨਾਂ ਨੂੰ ਕੋਈ ਵੀ ਜ਼ਰੂਰੀ ਕੰਮ ਹੁੰਦਾ ਹੈ ਜੋ ਈਬੈਂਕਿੰਗ ਰਾਹੀਂ ਨਹੀਂ ਕੀਤਾ ਜਾਂਦਾ ਗਾ ਠੀਕ ਹੈ ਜਾਂ ਫਿਰ ਅਗਰ ਉਹ ਕੈਸ਼ ਚਾਹੀਦਾ ਉਹਨਾਂ ਨੂੰ ਤਾਂ ਉਹ ਏ ਟੀ ਐੱਮ ਦੇ ਕੋਲ ਹੀ ਜਾਂਦਾ ਬੈਂਕ ਦੇ ਵਿੱਚ ਤਾਂ ਫਿਰ ਵੀ ਨਹੀਂ ਜਾਂਦੇ ਗੇ ਮਤਲਬ ਠੀਕ ਹੈ ਮਤਲਬ ਇਹ ਜਿਹੜੀ ਈਬੈਂਕਿੰਗ ਦੀ ਟੈਕਨੋਲੋਜੀ ਹੈਗੀ ਆ ਗੀ ਠੀਕ ਹੈ ਵੀ ਇਹਨੇ ਬਹੁਤ ਹੀ ਜ਼ਿਆਦਾ ਬੈਂਕਿੰਗ ਸੈਕਟਰ ਨੂੰ ਹੈਗਾ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕੀਤਾ ਹੈਗਾ ਠੀਕ ਹੈ ਐਂਡ ਅਸੀਂ ਵੀ ਜਿਵੇਂ ਹੁਣ ਇੰਡੀਆ ਦੇ ਵਿੱਚ ਹਾਂ ਇੰਡੀਆ ਦੇ ਵਿੱਚ ਸਾਰੇ ਆ ਜਾਂਦੇ ਆ ਮੈਂ ਵੀ ਆ ਜਾਂਦੀ ਹਾਂ ਵੀ ਆਪਾਂ ਵੇਖਦੇ ਹਾਂ ਵੀ ਅਸੀਂ ਆਪ ਵੀ ਕੀ ਹੈਗੇ ਆ ਬੈਂਕਿੰਗ ਐਪਸ ਦੀ ਵੀ ਵਰਤੋਂ ਬਹੁਤ ਹੀ ਜ਼ਿਆਦਾ ਕਰਦੇ ਹੈਗੇ ਹਾਂ